ਮੈਂ ਪੰਜਾਬ ਵਿੱਚ ਆਪਣੇ ਫਾਰਮ ਹਾਊਸ 'ਤੇ ਪੋਲਟਰੀ ਫਾਰਮ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਮੈਂ ਛੋਟੇ ਚੂਚਿਆਂ ਨੂੰ ਛੋਟੇ ਚਿਕਸ ਨੂੰ ਜੋ ਕਿ ਇੱਕ ਦਿਨ ਤੋਂ ਲੈ ਕੇ ਤੀਹ ਦਿਨ ਦੇ ਵਿੱਚ ਹਨ ਉਹਨਾਂ ਨੂੰ ਸਟਾਰਟਰ ਫੀਡ ਪਾਉਂਦਾ ਹਾਂ ਅਤੇ ਉਸ ਤੋਂ ਬਾਅਦ ਤੀਹ ਦਿਨਾਂ ਤੋਂ ਬਾਅਦ ਦੇ ਮੁਰਗੇ ਮੁਰਗੀਆਂ ਨੂੰ ਮੈਂ ਆਪਣੇ ਪੋਲਟਲੀ ਫਾਰਮ ਵਿੱਚ ਜਿੱਦਾਂ ਮੱਕਾ ਸੋਇਆਬੀਨ ਗੇਹੂ ਚਾਵਲ ਇਹ ਸਾਰਾ ਮਿਕਸ ਕਰਕੇ ਅਤੇ ਮੱਕੀ ਵੀ ਮਿਕਸ ਕਰਕੇ ਉਹਨਾਂ ਦਾ ਦਲੀਆ ਬਣਾ ਕੇ ਮੁਰਗਿਆਂ ਨੂੰ ਦਿੰਦਾ ਹਾਂ ਅਤੇ ਉਹਨਾਂ ਨੂੰ ਆਪਣੇ ਪਾਸ ਦੇ ਖੇਤਾਂ ਵਿੱਚ ਛੱਡ ਦਿੰਦਾ ਹਾਂ ਜਿਸ ਵਿੱਚ ਉਹ ਕੀੜੇ ਮਕੌੜੇ ਵੀ ਖਾਂਦੇ ਹਨ ਅਤੇ ਘਰ ਦੀ ਬਣੀ ਫੀਡ ਖਾ ਕੇ ਇਹ ਕਾਫੀ ਤੰਦਰੁਸਤ ਰਹਿੰਦੇ ਹਨ ਅਤੇ ਟਾਈਮ 'ਤੇ ਉਹਨਾਂ ਦੀ ਵੈਕਸੀਨੇਸ਼ਨ ਕਰਵਾਉਂਦਾ ਹਾਂ ਇਸ ਤੋਂ ਬਾਵਜੂਦ ਮੈਂ ਉਹਨਾਂ ਜੋ ਮੁਰਗੀਆਂ ਅੰਡੇ ਦੇਣ ਲੱਗ ਪਈਆਂ ਹਨ ਉਹਨਾਂ ਨੂੰ ਲੇਅਰ ਫੀਡ ਬਾਜ਼ਾਰ ਤੋਂ ਲੈ ਕੇ ਖਿਲਾ ਰਿਹਾ ਹਾਂ ਲੇਅਰ ਫੀਲਡ ਨਾਲ ਉਹਨਾਂ ਦਾ ਪ੍ਰੋਟੀਨ ਕੈਲਸ਼ੀਅਮ ਪੂਰਾ ਹੁੰਦਾ ਹੈ ਅਤੇ ਵਿੱਚ ਵਿੱਚ ਉਹਨਾਂ ਨੂੰ ਹਰਾ ਚਾਰਾ ਵੀ ਦਿੰਦਾ ਹਾਂ ਜਿਸ ਨਾਲ ਉਹਨਾਂ ਦਾ ਕੈਲਸ਼ੀਅਮ ਭਰਪੂਰ ਰਹੇ ਅਤੇ ਉਹ ਤੰਦਰੁਸਤ ਅਤੇ ਵਧੀਆ ਤਰੀਕੇ ਨਾਲ ਆਂਡੇ ਟਾਈਮ 'ਤੇ ਦਿੰਦੇ ਰਹਿਣ ਇਸ ਤੋਂ ਇਲਾਵਾ ਮੈਂ ਮੁਰਗਿਆਂ ਨੂੰ ਗਰਮੀ ਤੋਂ ਬਚਣ ਲਈ ਕੂਲਰ ਅਤੇ ਸਰਦੀ ਤੋਂ ਬਚਣ ਲਈ ਹੀਟਰ ਦਾ ਇਸਤੇਮਾਲ ਵੀ ਕਰਦਾ ਹਾਂ ਅਤੇ ਟਾਈਮ ਸਿਰ ਲਾਈਟ ਅਤੇ ਹਨੇਰੇ ਦੀ ਵਰਤੋਂ ਵੀ ਕਰਦਾ ਹਾਂ